ਪੰਜਾਬ ਵਿੱਚ ਨਿਊਜ਼ ਮੀਡੀਆ ਬਹੁਤ ਅੱਛੀ ਤਰ੍ਹਾਂ ਕਵਰ ਕਰਦਾ ਹੈ ਸਾਡੇ ਸਮਾਜਿਕ ਭਾਈਚਾਰੇ ਨੂੰ ਸੱਭਿਆਚਾਰ ਦੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ ਉਹਨਾਂ ਨੂੰ ਕਵਰ ਕਰਨ ਦਾ ਬਹੁਤ ਹੀ ਅੱਛਾ ਅਤੇ ਬੜਾ ਸਮਝਦਾਰੀ ਨਾਲ ਮੈਚਿਓਰਟੀ ਨਾਲ ਦਿੰਦਾ ਹੈ ਤਾਂ ਕਿ ਅੱਗੇ ਵੀ ਇਸਦਾ ਭਾਈਚਾਰਾ ਨੂੰ ਬਣਾਈ ਰੱਖਣ ਇਹਦਾ ਬੜਾ ਪੋਜੀਟਿਵ ਰੋਲ ਹੈ